ਹੈਲੋ ਸਤਿ ਸ਼੍ਰੀ ਅਕਾਲ ਜੀ ਅਸੀਂ ਮੀਡੀਆ ਤੋਂ ਹਾਂ ਅਸੀਂ ਤੁਹਾਡੇ ਤੋਂ ਨਾ ਪਿਛਲੇ ਕੁਝ ਕੁ ਮਹੀਨਿਆਂ ਤੋਂ ਬਾਰਿਸ਼ ਕਰਕੇ ਕੀ ਨੁਕਸਾਨ ਹੋਇਆ ਤੁੁਹਾਡੇ ਜ਼ਿਲ੍ਹੇ ਦੇ ਵਿੱਚ ਆਸ ਪਾਸ ਦੇ ਇਲਾਕਿਆਂ ਦੇ ਵਿੱਚ ਉਹਦਾ ਬਾਰੇ ਪੁੱਛਣਾ ਚਾਹੁੰਦੇ ਹਾਂ ਅਤੇ ਸਾਨੂੰ ਇਹ ਦੱਸੋ ਕਿ ਇਹਦਾ ਵੱਡਾ ਰੀਜਨ ਕੀ ਸੀ ਵੀ ਇਹ ਐਨੀ ਜ਼ਿਆਦਾ ਬਾਰਿਸ਼ ਕਿਉਂ ਹੋਈ ਹਾਂਜੀ

ਹਾਂਜੀ ਹਾਂਜੀ ਹਾਂਜੀ ਹਾਂਜੀ ਸਹੀ ਗੱਲ ਆ ਸਹੀ ਗੱਲ ਜੀ

ਹਾਂਜੀ ਹਾਂਜੀ ਠੀਕ ਹੈ ਜੀ ਧੰਨਵਾਦ